ਹਾਂਜੀ ਜੇਕਰ ਅਸੀਂ ਪੰਜਾਬੀ ਦੀ ਕਿਤਾਬਾਂ ਬਾਰੇ ਗੱਲ ਕਰੀਏ ਤਾਂ ਪੰਜਾਬੀ ਦੀ ਕਿਤਾਬਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਮੈਂ ਪੰਜਾਬੀ ਦੀ ਕਿਤਾਬਾਂ ਵਿੱਚ ਮਹਾਤਮਾ ਗਾਂਧੀ ਦੀ ਸਟੋਰੀਆਂ ਬਾਰੇ ਬੜਾ ਜ਼ਿਆਦਾ ਪੜ੍ਹਿਆ ਹੋਇਆ ਜਿਸ ਵਿੱਚ ਪਰਿਵਾਰ ਬਾਰੇ ਵੀ ਦੱਸਿਆ ਗਿਆ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਉਹ ਕਿੱਦਾਂ ਰਹਿੰਦੇ ਸੀ ਉਹ ਸਾਦਗੀ ਨਾਲ ਜੀਵਨ ਬਤੀਤ ਕਰਦੇ ਸੀ ਜੋ ਕਿ ਅਸੀਂ ਅੱਜ ਤੱਕ ਉਹਨਾਂ ਦੀ ਕਿਤਾਬਾਂ ਬਾਰੇ ਅਸੀਂ ਆਪਣੇ ਪਰਿਵਾਰ ਨਾਲ ਵੀ ਗੱਲਾਂ ਸਾਂਝੀਆਂ ਕਰਦੇ ਹਾਂ ਉਸ ਵਿੱਚ ਉਹਨਾਂ ਨੇ ਆਪਣੇ ਬਾਰੇ ਅਵਦੇਸ਼ ਬਾਰੇ ਉਹਨਾਂ ਨੇ ਜੋ ਕੁਛ ਕੀਤਾ ਉਹਨਾਂ ਨੇ ਸਾਰੀ ਉਸ ਵਿੱਚ ਆਪਣੇ ਬਾਰੇ ਦੱਸਿਆ ਹੋਇਆ ਹੈ ਉਹ ਹਮੇਸ਼ਾ ਆਪਣੇ ਪਰਿਵਾਰ ਨਾਲ ਆਪਣਾ ਸੁਖਮਈ ਜੀਵਨ ਬਤੀਤ ਕਰਨਾ ਪਸੰਦ ਕਰਦੇ ਸਨ ਉਹਨਾਂ ਬਾਰੇ ਹੋਰ ਵੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕਿਤਾਬਾਂ ਅਸੀਂ ਪੜ੍ਹੀਆਂ ਹਨ ਜਿਹਨਾਂ ਵਿੱਚ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਦੇ ਅੱਜ ਦੇ ਸਮੇਂ ਵਿੱਚ ਵੀ ਪੰਜਾਬੀ ਕਿਤਾਬਾਂ ਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਹਰ ਚੀਜ਼ ਬਾਰੇ ਸਾਨੂੰ ਦੱਸਿਆ ਜਾ ਰਿਹਾ ਪਰਿਵਾਰ ਦਾ ਰਹਿਣ ਸਹਿਣ ਪਰਿਵਾਰ ਵਿੱਚ ਕਿੱਦਾਂ ਰਹਿਣਾ ਕਿ ਕਿੱਦਾਂ ਕਿਸੇ ਦਾ ਸਨਮਾਨ ਆਦਰ ਸਨਮਾਨ ਕਰਨਾ ਹਰ ਚੀਜ਼ ਬਾਰੇ ਅਸੀਂ ਉਸ ਵਿੱਚ ਨੌਲੇਜ ਲੈ ਸਕਦੇ ਹਾਂ ਔਰ ਕਿਤਾਬਾਂ ਦੀ ਗੱਲ ਕੀਤੀ ਜਾਏ ਤਾਂ ਪੰਜਾਬੀ ਵਿੱਚ ਬਹੁਤ ਪ੍ਰਕਾਰ ਦੀਆਂ ਕਿਤਾਬਾਂ ਹਨ ਜਿਹਨਾਂ ਵਿੱਚ ਸਾਨੂੰ ਹਰ ਪ੍ਰਕਾਰ ਦੀ ਨੌਲੇਜ ਮਿਲਦੀ ਹੈ ਅਸੀਂ ਸਿੱਖਦੇ ਹਾਂ ਤਾਂ ਜੋ ਕਿ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਵੀ ਕਿਤਾ ਪੰਜਾਬੀ ਕਿਤਾਬਾਂ ਬਾਰੇ ਕੁਛ ਨਾ ਕੁਛ ਸਮਝਾਉਂਦੇ ਰਹਿੰਦੇ ਹਾਂ ਜਿਸ ਕਰਕੇ ਪੰਜਾਬੀ ਭਾਸ਼ਾ ਵੀ ਬਹੁਤ ਵਧੀਆ ਮੰਨੀ ਗਈ ਹੈ